ਮੇਰੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਿਤੀ ਬਹੁਤ ਮਾੜੀ ਹੈ ਮੈਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਹੀ ਭੇਜਣਾ ਪਸੰਦ ਕਰਾਂਗਾ ਕਿਉਂਕਿ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਜ਼ਿਆਦਾ ਕੇਅਰ ਨਹੀਂ ਹੁੰਦੀ ਬੱਚਿਆਂ ਦੀ ਅਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਸਮਝਣਾ ਬਹੁਤ ਜ਼ਿਆਦਾ ਘੱਟ ਹੁੰਦਾ ਸਰਕਾਰੀ ਸਕੂਲਾਂ ਦੇ ਵਿੱਚ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਬੱਚੇ ਨੂੰ ਜ਼ਿਆਦਾ ਸਮਝਦੇ ਹਨ ਠੀਕ ਆ ਅਤੇ ਉਸਦੇ ਅਨੁਸਾਰ ਪੜ੍ਹਾਈ ਵੀ ਬਹੁਤ ਅੱਛੀ ਕਰਵਾਈ ਜਾਂਦੀ ਹੈ ਅਤੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਾਈ ਦਾ ਲੈਵਲ ਬਹੁਤ ਹੀ ਮਾੜਾ ਹੈ ਅਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦਾ ਪੜ੍ਹਾਈ ਦਾ ਲੈਵਲ ਬਹੁਤ ਵਧੀਆ ਹੈ ਬੱਚੇ ਦੇ ਅਨੁਸਾਰ ਹੈ ਠੀਕ ਹੈ ਜੀ ਉਸ ਦੇ ਅਨੁਸਾਰ ਉਹ ਬੱਚੇ ਨੂੰ ਨਾਲ ਨਾਲ ਖਿਡਾਉਂਦੇ ਅਤੇ ਨਾਲ ਨਾਲ ਪੜ੍ਹਾਉਂਦੇ ਵੀ ਹਨ ਪਲੇ ਵੇ ਮੈਥਡ ਹੁੰਦਾ ਹੈ ਠੀਕ ਹੈ ਅਤੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਸਿਰਫ ਇਹ ਹੁੰਦਾ ਹੈ ਕਿ ਅਸੀਂ ਸਿਰਫ ਖਾਨਾ ਪੂਰਤੀ ਕਰਨੀ ਹੈ ਅਤੇ ਸਰਕਾਰ ਦੇ ਤੋਂ ਬਾਅਦ ਅਸੀਂ ਪੈਸੇ ਲੈਣੇ ਨੇ ਠੀਕ ਹੈ ਸਰਕਾਰੀ ਸਕੂਲਾਂ ਦਾ ਇਹ ਸਿਸਟਮ ਹੁੰਦਾ ਹੈ ਅਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਜਿਹੜੇ ਹੈੱਡ ਹੁੰਦੇ ਹਨ ਉਹਨਾਂ ਦੇ ਅਨੁਸਾਰ ਬੱਚਿਆਂ ਦਾ ਲੈਵਲ ਦੇਖ ਕੇ ਬੁਕਸ ਲਗਾਈਆਂ ਜਾਂਦੀਆਂ ਹਨ ਕਿਤਾਬਾਂ ਲਗਾਈਆਂ ਜਾਂਦੀਆਂ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਉਹ ਨਾਲ ਨਾਲ ਖਿਡਾਉਂਦੇ ਅਤੇ ਪੜ੍ਹਾਉਂਦੇ ਹਨ ਠੀਕ ਹੈ ਉਹਨਾਂ ਦਾ ਜਿਹੜੇ ਖਾਣ ਪੀਣ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਬਾਅਦ ਉਹ ਤੋਂ ਇਲਾਵਾ ਬੱਚਿਆਂ ਦਾ ਜਿਹੜਾ ਮਾਨਸਿਕ ਸਥਿਤੀ ਸਥਿਤੀ ਹੁੰਦੀ ਹੈ ਉਹਨੂੰ ਵੀ ਸਮਝਿਆ ਜਾਂਦਾ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਇਹ ਕੇਅਰ ਕੀਤੀ ਜਾਂਦੀ ਹੈ ਅਤੇ ਇਹੀ ਕਹਿੰਦਾ ਹੋਇਆ ਮੈਂ ਇਹ ਚਾਹਾਂਗਾ ਕਿ ਪ੍ਰਾਈਵੇਟ ਸਕੂਲ ਬਹੁਤ ਅੱਛੇ ਹੁੰਦੇ ਹਨ ਅਤੇ ਬੱਚੇ ਦੀ ਮਾਨਸਿਕ ਸਥਿਤੀ ਨੂੰ ਸਮਝਦੇ ਹੋਏ ਬੱਚਿਆਂ ਦਾ ਉਹ ਪੜ੍ਹਾਈ ਦਾ ਲੈਵਲ ਬਹੁਤ ਅੱਛਾ ਬਣਾਉਂਦੇ ਹਨ